ਮੈਨੂੰ ਸਥਾਨਕ ਖੇਡਾਂ ਵਿਚੋਂ ਰੱਸਾ ਖਿੱਚਣਾ ਜਿਹੜਾ ਉਹ ਬਹੁਤ ਪਸੰਦ ਐ ਕਿਉਂਕਿ ਇਹਦੇ ਨਾਲ ਦੋਨੋਂ ਟੀਮਾਂ ਨੂੰ ਇੱਕੋ ਜਿਹਾ ਮੌਕਾ ਮਿਲਦਾ ਹੈ ਪਰ ਮੈਂ ਇਸ ਖੇਡ ਨੂੰ ਸਿਰਫ ਦੇਖਣਾ ਪਸੰਦ ਕਰਦਾ ਹਾਂ ਕਿਉਂਕਿ ਮੈਨੂੰ ਇਹਦੇ ਨਾਲ ਜੋਸ਼ ਮਿਲਦਾ ਹੈ ਉਂਝ ਮੈਂ ਇਸਨੂੰ ਆਪ ਕਰਨਾ ਪਸੰਦ ਨਹੀਂ ਕਰਦਾ